ਅਸੀਂ ਪਕਸ਼ੀਆਂ ਨਾਲ਼ ਜੁੜੀਆਂ ਹੋਈਆਂ ਮਿਥਿਹਾਸਿਕ ਕਥਾਵਾਂ ਤਾਂ ਬਹੁਤ ਸੁਣੀਆਂ ਨੇ ਜੇ ਜਿਹੜੀਆਂ ਕਾਫ਼ੀ ਪ੍ਰਚਲਿਤ ਵੀ ਨੇ ਤੇ ਵਧੀਆ ਵੀ ਨੇ ਇਨ੍ਹਾਂ ਦੇ ਵਿੱਚੋਂ ਇੱਕ ਪਿਆਸੇ ਕਉਏ ਦੀ ਕਹਾਣੀ ਜਿਹੜੀ ਐ ਬਹੁਤ ਜ਼ਿਆਦਾ ਮਸ਼ਹੂਰ ਐ ਤੇ ਜਿਹੜੀ ਆਪਾਂ ਬਚਪਨ ਤੋਂ ਸੁਣੇ ਆ ਰਹੇ ਆਂ ਤੇ ਸਾਡੇ ਬੜੀ ਦਿਲ ਦੇ ਬਹੁਤ ਕਰੀਬ ਐ ਕਿਸ ਤਰ੍ਹਾਂ ਪਿਆਸਾ ਕਊਆ ਉੱਡਦਾ ਉੱਡਦਾ ਆਉਂਦਾ ਐ ਘੜੇ ਕੋਲ਼ ਤੇ ਉਨ ਦੇ ਵਿੱਚ ਪਾਣੀ ਬੜਾ ਥੋੜ੍ਹਾ ਹੁੰਦਾ ਐ ਓਨ ਦੀ ਚੁੰਝ ਪਾਣੀ ਤੱਕ ਨਹੀਂ ਪੌਂਚ ਰਹੀ ਉਹ ਹੌਲੀ ਹੌਲੀ ਤਰਕੀਬ ਲਗਾਂਦਾ ਐ ਕੀ ਮੈਂ ਕਿਸ ਤਰ੍ਹਾਂ ਪਾਣੀ ਪੀਵਾਂ ਫੇਰ ਹੌਲੀ ਹੌਲੀ ਉਨ ਦੇ ਕੋਲ਼ ਪੱਥਰ ਪਏ ਹੁੰਦੇ ਨੇ ਉਹ ਉਨ੍ਹਾਂ ਨੂੰ ਚੁੱਕਦਾ ਐ ਇੱਕ ਇੱਕ ਕਰਕੇ ਤੇ ਘੜੇ ਵਿੱਚ ਪਾਂਦਾ ਐ ਤੇ ਘੜੇ ਦਾ ਪਾਣੀ ਉੱਪਰ ਆ ਜਾਂਦਾ ਐ ਤੇ ਉਹ ਪਾਣੀ ਪੀ ਕੇ ਆਪਣੀ ਪਿਆਸ ਬੁਝਾ ਲੈਂਦਾ ਐ ਐਹ ਕਹਾਣੀ ਅਸੀਂ ਬਚਪਨ ਤੋਂ ਸੁਣੇ ਆ ਰਹੇ ਆਂ ਹੁਣ ਆਪਣੇ ਬੱਚਿਆਂ ਨੂੰ ਵੀ ਸੁਣਾਈਏ ਸਾਰਿਆਂ ਨੂੰ ਬੜੀ ਦਿਲ ਦੇ ਕਰੀਬ ਲੱਗੀ ਐ ਹੁਣ ਅੱਗੋਂ ਆਪਣੇ ਪੋਤਰੀਆਂ ਪੋਤਰੀ ਨੂੰ ਵੀ ਸੁਣਾ ਰਹੇ ਆਂ ਉਹ ਵੀ ਬੱਚਿਆਂ ਨੂੰ ਕਹਾਣੀ ਐਹ ਬਹੁਤ ਪਸੰਦ ਆਈ ਐ ਇਸ ਕਹਾਣੀ ਤੋਂ ਸਾਨੂੰ ਐ ਸਿਕਸ਼ਾ ਮਿਲਦੀ ਕੀ ਕੋਈ ਵੀ ਔਖੀ ਘੜੀ ਹੋਵੇ ਸਾਨੂੰ ਘਬਰਾਣਾ ਨੀ ਚਾਈਦਾ ਹੌਲੀ ਹੌਲੀ ਦਿਮਾਗ ਲਗਾ ਕੇ ਸੋਚਣਾ ਚਾਈਦਾ ਐ ਕੀ ਐਨੂੰ ਅਸੀਂ ਕਿੱਦਾਂ ਮੁਸ਼ਕਿਲ ਤੋਂ ਮੁਸ਼ਕਿਲ ਵਿੱਚੋਂ ਨਿਕਲੀਏ ਜਿਵੇਂ ਪਿਆਸਾ ਕਊਆ ਸੋਚ ਸੋਚ ਕੇ ਇੱਕ ਇੱਕ ਪੱਥਰ ਸੁੱਟ ਕੇ ਤੇ ਪਾਣੀ ਕਰਦਾ ਉੱਪਰ ਆਂਦਾ ਐ ਇਸ ਤਰ੍ਹਾਂ ਈ ਸਾਨੂੰ ਵੀ ਔਖੇ ਮੁਸ਼ਕਿਲ ਟੈਮ ਤੇ ਘਬਰਾਣਾ ਨੀ ਚਾਈਦਾ ਐਹ ਕਹਾਣੀ ਸਾਡੇ ਬੜੇ ਦਿਲ ਦੇ ਕਰੀਬ ਐ ਤੇ ਬਹੁਤ ਵਧੀਆ ਐ ਸਭ ਨੂੰ ਬਹੁਤ ਵਧੀਆ ਲੱਗਦੀ ਐ